ਹੈਲੋ ਤੁਸੀਂ ਕੈਬ ਏਜੰਸੀ ਤੋਂ ਗੱਲ ਕਰ ਰਹੇ ਹੋ ਮੈਂ ਕੱਲ ਰੋਪੜ ਤੋਂ ਦਿੱਲੀ ਦੇ ਲਈ ਕੈਬ ਬੁੱਕ ਕੀਤੀ ਸੀ ਜਿਵੇਂ ਹੀ ਕੈਬ ਮੇਰੇ ਕੋਲ ਆਈ ਜਿਵੇਂ ਹੀ ਕੈਬ ਮੇਰੇ ਕੋਲ ਆਈ ਮੈਂ ਦੇਖਿਆ ਡਰਾਈਵਰ ਨੂੰ ਨਾਂ ਤਾਂ ਉਹਨੇ ਮਾਸਕ ਪਾਇਆ ਸੀ ਨਾਂ ਉਹਦੇ ਹੱਥ 'ਚ ਗਲੱਬਸ ਸੀ ਫਿਰ ਫਿਰ ਵੀ ਮੈਂ ਦੇਖਿਆ ਫਿਰ ਮੈਂ ਦਰਵਾਜ਼ਾ ਖੋਲਿਆ ਅਤੇ ਦੇਖਿਆ ਸੀਟਾਂ ਬਹੁਤ ਜ਼ਿਆਦਾ ਹੀ ਗੰਦੀਆਂ ਸੀ ਪਰ ਫਿਰ ਵੀ ਮੈਂ ਬੈਠ ਗਈ ਅਤੇ ਜਰਸੀਮ ਜਿਵੇਂ ਕਿ ਤੁਹਾਨੂੰ ਪਤਾ ਹੈ ਇਸ ਟਾਈਮ ਮਹਾਂਮਾਰੀ ਦਾ ਟਾਈਮ ਚੱਲ ਰਿਹਾ ਹੈ ਕਿੰਨਾ ਜ਼ਿਆਦਾ ਖ਼ਤਰਾ ਹੈ ਅਤੇ ਤੁਹਾਨੂੰ ਪਤਾ ਜਰਸੀਮ ਕੀਟਾਣੂ ਕਿੰਨੇ ਜ਼ਿਆਦਾ ਉਸਦੇ ਨਾਲ ਮੇਰੀ ਜਾਨ ਦੇ ਵਿੱਚ ਖ਼ਤਰਾ ਹੈ ਇਸ ਲਈ ਮੈਂ ਉਸ ਡਰਾਈਵਰ ਨੂੰ ਦੇਖਿਆ ਉਹ ਹਰ ਜਗ੍ਹਾ ਰੁਕ ਰੁਕ ਕੇ ਕਿਤੇ ਨਾ ਕਿਤੇ ਚਾਹ ਪੀ ਰਿਹਾ ਸੀ ਕਿਸੇ ਨਾਲ ਵੀ ਹੈਂਡਸ਼ੇਕ ਕਰ ਰਿਹਾ ਸੀ ਅਤੇ ਨਾ ਉਹ ਹ ਹੱਥ ਵਾਸ਼ ਕਰ ਰਿਹਾ ਸੀ ਇਸ ਨਾਲ ਸਭ ਤੋਂ ਜ਼ਿਆਦਾ ਮੇਰੀ ਜਾਨ ਨੂੰ ਖ਼ਤਰਾ ਸੀ ਮੈਂ ਫਿਰ ਵੀ ਤੁਹਾਨੂੰ ਸੂਚਿਤ ਕੀਤਾ ਵੀ ਅੱਗੇ ਤੋਂ ਮੈਂ ਅੱਗੇ ਤੋਂ ਮੈਂ ਜਾਣਾ ਚਾਹੂੰਗੀ ਕਿਤੇ ਵੀ ਅਤੇ ਤੁਸੀਂ ਆਪਣੇ ਡਰਾਈਵਰ ਨੂੰ ਸੂਚਿਤ ਕਰੋ ਵੀ ਇਦਾਂ ਦੀ ਗਲਤੀ ਨਾ ਕਰੇ ਅਤੇ ਹੋਰ ਵੀ ਡਰਾਈਵਰ ਨੂੰ ਸੂਚਿਤ ਕਰੋ ਵੀ ਕਸਟਮਰ ਦੀ ਜਾਨ ਨੂੰ ਖ਼ਤਰਾ ਹੋ ਸਕਦਾ